ਪੰਜਾਬ ਦਾ ਸੱਭਿਆਚਾਰ ਬਹੁਤ ਬਹੁਤ ਵਧੀਆ ਹੈ ਜਦ ਪੰਜਾਬ ਵਿੱਚ ਵਿਆਹ ਹੁੰਦਾ ਆ ਸਭ ਤੋਂ ਪਹਿਲਾਂ ਤਾਂ ਘਰ ਵਿੱਚ ਪਾਠ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਹੈ ਅਤੇ ਤਿੰਨ ਦਿਨ ਅਖੰਡ ਪਾਠ ਸਾਹਿਬ ਦਾ ਪਾਠ ਚੱਲਦਾ ਹੈ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਉਸ ਤੋਂ ਬਾਅਦ ਨਾਨਕਿਆਂ ਦੀ ਐਂਟਰੀ ਹੁੰਦੀ ਹੈ ਨਾਨਕੇ ਆਪਣੇ ਨਾਨਕੀ ਸ਼ੱਕ ਲੈ ਕੇ ਆਉਂਦੇ ਹਨ ਜੋ ਵੀ ਉਹਨਾਂ ਦੀ ਸ਼ਰਧਾ ਹੁੰਦੀ ਹੈ ਜੇ ਕੁੜੀ ਦਾ ਵਿਆਹ ਕੁੜੀ ਲਈ ਚੂੜਾ ਚੂ ਕੁੜੀ ਲਈ ਕੱਪੜੇ ਕੁੜੀ ਦੀ ਮਾਂ ਪਿਓ ਲਈ ਕੱਪੜੇ ਭੈਣਾਂ ਭਰਾਵਾਂ ਲਈ ਹੋ ਗਏ ਅਤੇ ਜੋ ਬਣਦਾ ਸਰਦਾ ਉਹ ਸਭ ਕੁਛ ਦਿੰਦੇ ਨੇ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਜਿਵੇਂ ਕਿ ਡੀਜੇ ਜਾਂ ਲੇਡੀ ਸੰਗੀਤ ਹੋ ਗਿਆ ਪਹਿਲਾਂ ਲੇਡੀ ਸੰਗੀਤ ਹੁੰਦਾ ਸੀ ਲੇਡੀਜ਼ ਨੱਚਦੀਆਂ ਟੱਪਦੀਆਂ ਸੀ ਆਪਸ 'ਚ ਘੁੱਲਦੀਆਂ ਮਿਲਦੀਆਂ ਸੀ ਢੋਲਕੀ ਅਤੇ ਡਾਂਸ ਕਰਦੀਆਂ ਸੀ ਪਰ ਅੱਜ ਕੱਲ੍ਹ ਉਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਮੂਵ ਹੋ ਕੇ ਡੀਜਿਆਂ ਦਾ ਚੱਲ ਪਿਆ ਵੀ ਡੀਜੇ ਲੋਕ ਚਲਾਉਂਦੇ ਨੇ ਚਲੋ ਰਾਤ ਨੂੰ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਰੋਟੀ ਪਾਣੀ ਖਾਂਦੇ ਨੇ ਤਾਂ ਸੋ ਜਾਂਦੇ ਨੇ ਸਵੇਰ ਨੂੰ ਉੱਠ ਕੇ ਮਾਮਾ ਮਾਮਾ ਆਪਣੀ ਭਾਣਜੀ ਨੂੰ ਚੂੜਾ ਪੁਆਈ ਦੀ ਰਸਮ ਕਰਦੇ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਨੁ ਉਹਦੇ ਨੁਆਣ ਦੇ ਵਿੱਚ ਉਹਦੀਆਂ ਮਾਮੀਆਂ ਮਦਦ ਕਰਦੀਆਂ ਇੱਕ ਇਹ ਵੀ ਸ਼ਗਨ ਹੁੰਦਾ ਵੀ ਮਾਮੇ ਮਾਮੀਆਂ ਨੁਆਉਂਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਆ ਉਹ ਚੂੜਾ ਪੁਆਈ ਦੀ ਸ਼ਗਨ ਹੁੰਦਾ ਇਹ ਸਿਰਫ ਮਾਮਿਆਂ ਦਾ ਹੀ ਹੁੰਦਾ ਵੀ ਮਾਮੇ ਹੀ ਚੂੜਾ ਪੁਆਉਣ ਅਤੇ ਮਾਮੇ ਹੀ ਚੂੜਾ ਲੈ ਕੇ ਆਉਂਦੇ ਨੇ ਤਾਂ ਮਾਮੇ ਕੱਚੀ ਲੱਸੀ ਦੇ ਵਿੱਚ ਚੂੜਾ ਧੋ ਕੇ ਪਾਉਂਦੇ ਨੇ ਅਤੇ ਉਹ ਰਸਮ ਸਭ ਤੋਂ ਵਧੀਆ ਹੁੰਦੀ ਆ ਇਹ ਸਾਰੇ ਮਾਮੇ ਇਕੱਠੇ ਹੋ ਕੇ ਇਹ ਰਸਮ ਨੂੰ ਪੂਰਾ ਕਰਦੇ ਨੇ ਉਸ ਤੋਂ ਬਾਅਦ ਚਲੋ ਪੈਲਿਸ 'ਚ ਜਾਂਦੇ ਆ ਪੈਲਿਸ 'ਚ ਬਰਾਤ ਦਾ ਸਵਾਗਤ ਹੁੰਦਾ ਆ ਸਭ ਤੋਂ ਮੇਨ ਰਸਮ ਹੋ ਗਈ ਵਿਆਹ ਦੀ ਲਾਵਾਂ ਚਾਰ ਫੇਰੇ ਹੁੰਦੇ ਨੇ ਆਪਣੇ ਸਿੱਖ ਧਰਮ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਸੱਤ ਹੁੰਦੇ ਨੇ ਆਪਣੀ ਪੂਰੀ ਸ਼ਰਧਾ ਨਾਲ ਕਰਿਆ ਜਾਂਦਾ ਇਹੀ ਅਸਲ ਵਿਆਹ ਹੁੰਦਾ ਏ ਆ ਵੀ ਲਾਵਾਂ ਹੋ ਗਈਆਂ ਤਾਂ ਅਸਲ ਵਿਆਹ ਹੋ ਗਿਆ ਬਾਕੀ ਚਲੋ ਜੋ ਆਪਣੇ ਬਣਦੇ ਨੇ ਰੀਤੀ ਰਿਵਾਜ਼ ਆਪਾਂ ਪੂਰੇ ਕਰਦੇ ਹਾਂ ਤਾਂ ਵਿਆਹ ਬਹੁਤ ਵਧੀਆ ਕਿਸਮ ਨਾਲ ਨਿਭਾਇਆ ਜਾਂਦਾ ਜਦ ਕਿ ਸਭ ਤੋਂ ਪਹਿਲਾਂ ਬਾਰ੍ਹਾਂ ਵਜੇ ਤੋਂ ਪਹਿਲਾਂ ਪਹਿਲਾਂ ਹੀ ਲਾਵਾਂ ਹੋਣੀਆਂ ਚਾਹੀਦੀਆਂ ਅਸਲੀ ਮਾਈਨੇ ਇਹੀ ਹੀ ਰੱਖਦਾ ਹੈ